ਮੇਰਾ ਕੰਮ ਅਧਿਆਪਕ ਦਾ ਹੈ ਔਰ ਮੈਂ ਇਸ ਕਿੱਤੇ ਨੂੰ ਬੜੀ ਲਗਨ ਅਤੇ ਦਿਲਚਸਪੀ ਨਾਲ ਕਰਦੀ ਹਾਂ ਬੱਚਿਆਂ ਨੂੰ ਪੜ੍ਹਾਉਣਾ ਉਹਨਾਂ ਨੂੰ ਚੰਗੀ ਸਿੱਖਿਆ ਦੇਣਾ ਇਕ ਅਧਿਆਪਕ ਦਾ ਮੁੱਢਲਾ ਜਿਹੜਾ ਆ ਉਹ ਕਰੈਕਟਰ ਆ ਮੁੱਢਲਾ ਚਰਿੱਤਰ ਹੈ ਕੇ ਉਹ ਬੱਚਿਆਂ ਨੂੰ ਚੰਗੀ ਤਰ੍ਹਾਂ ਪੜ੍ਹਾਵੇ ਔਰ ਇਸ ਤੋਂ ਕੰਮ ਇਸ ਕੰਮ ਤੋਂ ਬਾਹਰ ਮੇਰੇ ਹੋਰ ਵੀ ਕੁਝ ਸ਼ੌਂਕ ਨੇ ਦਿਲਚਸਪੀਆਂ ਨੇ ਜਿਵੇਂ ਸ਼ੌਂਕ ਆ ਜਿਵੇਂ ਮੈਂ ਮਿਊਜਿਕ ਸੁਣਨਾ ਪਸੰਦ ਹੈ ਮੈਨੂੰ ਜਾਂ ਆਪਣੇ ਮਿੱਤਰਾਂ ਦੋਸਤਾਂ ਨਾਲ ਗੱਲਾਂ ਕਰਨੀਆਂ ਪਸੰਦ ਨੇ ਜਾਂ ਮੈਨੂੰ ਸੌਂਗ ਲਿਖਣੇ ਪਸੰਦ ਨੇ ਮੈਂ ਕਵਿਤਾਵਾਂ ਲਿਖਣ ਵਿੱਚ ਵੀ ਦਿਲਚਸਪੀ ਜਿਹੜੀ ਆ ਉਹ ਰੱਖਦੀ ਹਾਂ ਮੈਨੂੰ ਖੇਡਣਾ ਬਹੁਤ ਪਸੰਦ ਹੈ ਬੱਚਿਆਂ ਦੇ ਨਾਲ ਸੋ ਇਹਦੇ ਨਾਲ ਇਹ ਹੈ ਕਿ ਆਪਾਂ ਆਪਣੇ ਕੰਮ ਤੋਂ ਹਟ ਕੇ ਥੋੜ੍ਹਾ ਜਿਹਾ ਸਮਾਜ ਦੇ ਵਿੱਚ ਜਦੋਂ ਵਿਚਰਦੇ ਹਾਂ ਤਾਂ ਸਾਨੂੰ ਬਹੁਤ ਸਾਰੀਆਂ ਗੱਲਾਂ ਦਾ ਪਤਾ ਲੱਗਦਾ ਆ ਬਹੁਤ ਸਾਰੀਆਂ ਚੀਜ਼ਾਂ ਦਾ ਪਤਾ ਲੱਗਦਾ ਆ ਜਿਨ੍ਹਾਂ ਤੋਂ ਆਪਣੇ ਗਿਆਨ ਵਿੱਚ ਵਾਧਾ ਸਾਨੂੰ ਮਿਲਦਾ ਆ ਇਸ ਤੋਂ ਇਲਾਵਾ ਜਿਹੜਾ ਵਾ ਉਹ ਕੁਕਿੰਗ ਕਰਨ ਦਾ ਵੀ ਮੈਨੂੰ ਬਹੁਤ ਸ਼ੌਂਕ ਹੈ ਕਿ ਮੈਂ ਵੱਖ ਵੱਖ ਤਰ੍ਹਾਂ ਦੇ ਖਾਣੇ ਬਣਾਵਾਂ ਅਤੇ ਆਪਣੀ ਨੌਲੇਜ ਨੂੰ ਹੋਰ ਇੰਪਰੂਵ ਕਰਾਂ ਇਸ ਤੋਂ ਇਲਾਵਾ ਚੰਗੀਆਂ ਕਿਤਾਬਾਂ ਪੜ੍ਹਨੀਆਂ ਤਾਂ ਸ਼ੌਂਕ ਤਾਂ ਬਹੁਤ ਸਾਰੇ ਨੇ ਪਰ ਮੈਂ ਮੇਨ ਮੇਨ ਸ਼ੌਂਕ ਜਿਹੜੇ ਉਹ ਦੱਸ ਰਹੀ ਹਾਂ ਕਿ ਇਸ ਤੋਂ ਇਲਾਵਾ ਮੈਨੂੰ ਕਿਤਾਬਾਂ ਪੜ੍ਹਨੀਆਂ ਚੰਗੇ ਚੰਗੇ ਨਾਵਲਕਾਰ ਪੜ੍ਹਨੇ ਉਹ ਮੈਨੂੰ ਬਹੁਤ ਪਸੰਦ ਨੇ ਅਤੇ ਉਹਨਾਂ ਤੋਂ ਮੈਨੂੰ ਸਿੱਖਣ ਲਈ ਬਹੁਤ ਕੁਛ ਮਿਲਦਾ ਆ ਅਤੇ ਆਪਾਂ ਦੂਜੇ ਨਾਲ ਵੀ ਆਪਣੇ ਇਹਨਾਂ ਦਾ ਵਿਚਾਰਾਂ ਦਾ ਜਿਹੜਾ ਵੀ ਵਿਚਾਰ ਵਟਾਂਦਰਾ ਵਾ ਉਹ ਇੱਕ ਦੂਜੇ ਨਾਲ ਐਕਸਚੇਂਜ ਕਰਦੇ ਹਾਂ ਇੱਕ ਦੂਜੇ ਨੂੰ ਆਪਣੀ ਜਿਹੜੀ ਆ ਉਹ ਨੌਲੇਜ ਪ੍ਰੋਵਾਈਡ ਕਰਦੇ ਹਾਂ